ਈ ਪੀ ਐੱਫ ਓ ਮੈਂਬਰ ਈ ਸੇਵਾ ਦੀ ਵੈਬਸਾਈਡ 'ਤੇ ਜਾਓ ਆਪਣੇ ਯੂ ਏ ਐੱਨ ਅਤੇ ਪਾਸਵਰਡ ਪਾਸਵਰਡ ਨਾਲ ਲੋਗਇੰਨ ਕਰੋ ਪ੍ਰਬੰਧਿਤ ਸ਼ੈਕਸਨ ਦੀ ਚੋਣ ਕਰੋ ਸੰਪਰਕ ਵੇਰਵੇ ਚੁਣੋ ਈਮੇਲ ਆਈ ਡੀ ਵਰਤ ਲਓ ਚੁਣੋ ਆਪਣੀ ਨਵੀਂ ਈਮੇਲ ਆਈ ਡੀ ਦਰਜ ਕਰੋ ਅਤੇ ਇਸਨੂੰ ਦੁਬਾਰਾ ਦਰਜ ਕਰੋ ਅਧਿਕਾਰ ਪਿੰਨ ਪ੍ਰਾਪਤ ਕਰੋ ਅਤੇ ਕਲਿੱਕ ਕਰੋ ਪ੍ਰਦਾਨ ਕੀਤੇ ਜਾਣ 'ਤੇ ਪਿੰਨ ਦਾਖਲ ਕਰੋ ਤਬਦੀਲ ਤਬਦੀਲੀਆਂ ਨੂੰ ਸੁਰੱਖਿਅਤ ਕਰੋ ਅਤੇ ਕਲਿੱਕ ਕਰੋ ਤੁਸੀਂ ਸਵਾਲਾਂ ਦੇ ਨਾਲ ਈ ਪੀ ਐੱਫ ਓ ਨਾਲ ਇੱਥੇ ਸੰਪਰਕ ਕਰੋ ਕਰ ਸਕਦੇ ਹੋ ਜਿਵੇਂ ਕਰਮਚਾਰੀ